ਹਾਂਜੀ ਅਸੀਂ ਰੋਜ਼ੀ ਰੋਟੀ ਦੇ ਲਈ ਬਿਜਲੀ 'ਤੇ ਬਹੁਤ ਜ਼ਿਆਦਾ ਨਿਰਭਰ ਹਾਂ ਸਾਡੇ ਦੇਖੋ ਅਸੀਂ ਜਿੱਦਾਂ ਮਿਕਸੀ ਚਲਾਉਣੀ ਹੁੰਦੀ ਆ ਮਾਈਕ੍ਰੋਵੇਵ ਓਵੋਨ ਫਰਿੱਜਾਂ ਸਾਰਾ ਕੁਛ ਬਿਜਲੀ ਨਾਲ ਹੀ ਚਲਦਾ ਆ ਪਰ ਬਾਕੀ ਬ ਜੇ ਨਾ ਬਿਜਲੀ ਕੱਟ ਹੋਵੇ ਤਾਂ ਸਾਰਾ ਕੁਛ ਖਰਾਬ ਹੋ ਜਾਂਦਾ ਬਿਜਲੀ ਦ ਵਿੱਚ ਦੁੱਧ ਵੀ ਖਰਾਬ ਹੋ ਜਾਂਦਾ ਮੱਖਣ ਵੀ ਖਰਾਬ ਹੋ ਜਾਂਦਾ ਸਭ ਕੁਛ ਖਰਾਬ ਹੋ ਜਾਂਦਾ ਸਬਜ਼ੀਆਂ ਵੀ ਖਰਾਬ ਹੋ ਜਾਂਦੀਆਂ ਫਿਰ ਇੱਦਾਂ ਕਰਕੇ ਨਾ ਮੰਤਰੀਆਂ ਨੂੰ ਨਹੀਂ ਚਾਹੀਦਾ ਕੱਟ ਲਾਉਣਾ ਵੀ ਇੱਦਾਂ ਦਾ ਚ ਵੀ ਆਪਣੇ ਸ ਤਰੀਕੇ ਨਾਲ ਕੱਟ ਲਾਉਣ ਜਾਂ ਕੁਛ ਵਾ ਇੱਦਾਂ ਬਹੁਤ ਔਖਾ ਹੁੰਦਾ ਆ ਅਤੇ ਬਾਕੀ ਜਿੱਦਾਂ ਹੁਣ ਵੈਸੇ ਜ ਰਾਤ ਨੂੰ ਜ ਹੋਵੇ ਸਾਨੂੰ ਬਿਜ ਪਤਾ ਨਹੀਂ ਲੱਗਦਾ ਬਿਜਲੀ 'ਚ ਕੀ ਸਮਾਨ ਵਰਤਣਾ ਕਿੱਦਾਂ ਕਰਨਾ ਬਿਜਲੀ ਵੈਸੇ ਤਾਂ ਇਨਵਰਟਰ ਰੱਖੇ ਹੋਏ ਆ ਲੱਗੇ ਹੋਏ ਘਰਾਂ ਵਿੱਚ ਪਰ ਜਿਹੜੇ ਘਰ ਨਾ ਇਨਵਰਟਰ ਹੋਣ ਉਹਨੂੰ ਔਖਾ ਹੁੰਦਾ ਵਾ ਵੀ ਅਸੀਂ ਕਿੱਦਾਂ ਵੀ ਸਬਜ਼ੀ ਗਲ ਜਲ ਤਾਂ ਨਹੀਂ ਗਈ ਜਾਂ ਕੁਛ ਨਹੀਂ ਹੋ ਗਈ ਤਾਂ ਕਰਕੇ ਇਨ੍ਹਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ